ਇੱਕ ਯਾਤਰੀ ਬੱਸ ਦੇ ਵਿੱਚ ਅਠਤਾਲੀ ਤੋਂ ਲੈ ਕੇ ਬਵੰਜਾ ਤੱਕ ਸੀਟਾਂ ਹੁੰਦੀਆਂ ਇਹ ਡਿਪੈਂਡ ਕਰਦਾ ਕਿ ਬਸ ਛੋਟੀ ਹੈ ਜਾਂ ਵੱਡੀ ਹੈ ਅਤੇ ਇਸ ਤੋਂ ਇਲਾਵਾ ਵੀ ਇੱਕ ਡਰਾਈਵਰ ਸੀਟ ਹੁੰਦੀ ਹੈ ਅਤੇ ਉਹਦੇ ਵਿੱਚ ਕਈ ਬੱਸਾਂ ਦੇ ਵਿੱਚ ਬਾਹਰਲੀ ਸਾਈਡ ਸਾਈਡ 'ਤੇ ਸਟੋਰੇਜ਼ ਲਈ ਬਣਾਇਆ ਹੁੰਦਾ ਕੈਬਿਨ ਕਹਿ ਸਕਦੇ ਜਿਹਨੂੰ ਆਪਾਂ ਜਿੱਥੇ ਮ ਯਾਤਰੀਆਂ ਦੇ ਵੱਡੇ ਵੱਡੇ ਬੈਗ ਵਗੈਰਾ ਉੱਥੇ ਰੱਖੇ ਜਾ ਸਕਦੇ ਆ ਅਤੇ ਵਿੰਡੋਜ਼ ਹੋ ਗਈਆਂ ਬੱਸ ਦੇ ਵਿੱਚ ਹਰ ਇੱਕ ਸੀਟ ਦੇ ਨਾਲ ਵਿੰਡੋਜ਼ ਹੁੰਦੀ ਹੈ ਅਤੇ ਬੱਸਾਂ ਮੋਸਟਲੀ ਡੀਜ਼ਲ 'ਤੇ ਹੀ ਚੱਲਦੀਆਂ ਆਈ ਥਿੰਕ ਅਤੇ ਬੱਸਾਂ ਰਾਹੀਂ ਮੈਂ ਕਾਫੀ ਸਫਰ ਕੀਤਾ ਆ ਉਸ ਲਈ ਮੈਂ ਦਿੱਲੀ ਤੱਕ ਬੱਸਾਂ 'ਤੇ ਹੀ ਗਈ ਹਾਂ ਇਸ ਤੋਂ ਇਲਾਵਾ ਅਸੀਂ ਇੱਕ ਵਾਰੀ ਟੂਰ 'ਤੇ ਵੀ ਗਏ ਸੀਗੇ ਸਾਊਥ ਵੱਲ ਟੂਰ 'ਤੇ ਉਹ ਵੀ ਇੱਕ ਬੱਸ ਹੀ ਗਏ ਸੀ ਉਹ ਸਾਡਾ ਸਭ ਤੋਂ ਲੰਬਾ ਟੂਰ ਸੀ ਬਾ ਬਾਏ ਬੱਸ ਸੋ ਬੱਸ ਵਧੀਆ ਇੱਕ ਸਸਤਾ ਸਾਧਨ ਹੈ ਮੇਨ ਗੱਲ ਹੈਗੀ ਹੈ ਕਿ ਬ ਬੱਸ ਜਿਹੜੇ ਹੈਗਾ ਯਾਤਰਾ ਦਾ ਇੱਕ ਸਸਤਾ ਸਾਧਨ ਹੈ ਇੱਕ ਸੁਵਿਧਾਜਨਕ ਸਾਧਨ ਹੈ